ਸਾਡੇ ਪਠਾਨਕੋਟ ਵਿੱਚ ਤਾਂ ਬਹੁਤ ਛੋਟੀਆਂ ਮੋਟੀਆਂ ਦੁਕਾਨਾਂ ਹਨ ਬੁਟੀਕ ਵਾਲੀਆਂ ਅਤੇ ਜੇ ਅਸੀਂ ਉੱਥੋਂ ਸਿੱਖਣ ਜਾਂਦੇ ਹਾਂ ਅਤੇ ਸਾਨੂੰ ਮਤਲਬ ਸਿੱਖਣ ਨੂੰ ਵੀ ਮਿਲਦਾ ਛੋਟੀਆਂ ਮੋਟੀਆਂ ਦੁਕਾਨਾਂ ਹਨ ਤਾਂ ਕਿ ਜਾ ਜੋ ਵੀ ਹੈ ਮਤਲਬ ਅਸੀਂ ਲਾਵਾਂ ਫੇਰੇ ਵਾਲਾ ਸੂਟ ਵੀ ਨਹੀਂ ਸਵਾ ਸਕਦੇ ਮਤਲਬ ਖੁਦ ਸਿਊਂ ਕੇ ਅਸੀਂ ਇੰਨਾ ਵਧੀਆ ਤਾਂ ਨਹੀਂ ਸੀਤਾ ਜਾਂਦਾ ਫਿਰ ਵੀ ਅਸੀਂ ਆਪਣੇ ਮਤਲਬ ਮਾੜਾ ਮੋਟਾ ਕਰ ਲੈਂਦੇ ਹਾਂ ਕਿ ਤਾਂ ਕਿ ਸਿਲਾਈ ਕਢਾਈ ਕੁਛ ਬੁਣਾਈ ਕਰਕੇ ਆਪਣਾ ਮਤਲਬ ਕਰ ਲੈਂਦੇ ਹਾਂ ਖੁਦ ਦਾ ਬਣਾ ਲੈਂਦੇ ਹਾਂ ਛੋਟੀਆਂ ਮੋਟੀਆਂ ਦੁਕਾਨਾਂ ਵਾ ਸਾਡੇ ਪਠਾਣਕੋਟ ਵਿੱਚ ਹੁੰਦੀਆਂ ਵਾ ਅਤੇ ਚਲੋ ਅਸੀਂ ਬਟੀਕ ਦਾ ਕੰਮ ਮਤਲਬ ਸਿੱਖ ਵੀ ਸਕਦੇ ਹਾਂ ਉਹਨਾਂ ਕੋਲ ਸਿੱਖ ਕੇ ਆਪਣਾ ਕਰ ਵੀ ਸਕਦੇ ਹਾਂ ਅਸੀਂ ਆਪਣੇ ਕੱਪੜੇ ਖੁਦ ਸਟਿੱਚ ਕਰ ਸਕਦੇ ਹਾਂ ਮਤਲਬ ਅਸੀਂ ਪਹਿਲਾਂ ਦੁਕਾਨ ਤੋਂ ਅਸੀਂ ਸਿੱਖ ਸਕਦੇ ਹਾਂ ਫਿਰ ਉੱਥੋਂ ਸਿੱਖ ਕੇ ਮਾੜਾ ਮੋਟਾ ਚਲੋ ਜਿੱਦਾਂ ਦਾ ਵੀ ਹੁੰਦਾ ਹੈ ਅਸੀਂ ਮਤਲਬ ਵਧੀਆ ਤਾਂ ਨਹੀਂ ਕਰ ਸਕਦੇ ਚਲੋ ਜਿੱਦਾਂ ਦਾ ਵੀ ਹੁੰਦਾ ਹੈ ਜਿੰਨਾ ਸਾਡਾ ਮਤਲਬ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਵਧੀਆ ਤੋਂ ਆਪਣੀ ਸਿਲਾਈ ਕਢਾਈ ਸਿੱਖ ਸਕੀਏ ਅਸੀਂ ਕਰ ਸਕੀਏ ਅਸੀਂ ਕਿਸੇ ਦੇ ਕੱਪੜੇ ਸਟਿੱਚ ਕਰ ਸਕਦੇ ਹਾਂ ਕੱਪੜੇ ਮਤਲਬ ਕਿਸੇ ਦੇ ਲੈ ਕੇ ਅਸੀਂ ਸਿਲਾਈ ਖੁਦ ਸਿੱਖ ਕੇ ਉਹਨਾਂ ਨੂੰ ਸਟਿੱਚ ਕਰੀਏ ਵਧੀਆ ਤਰੀਕੇ ਨਾਲ ਪਰ ਸਾਡੇ ਕੋਲ ਇਹਨਾਂ ਨਹੀਂ ਵਧੀਆ ਹੁੰਦਾ ਕਿਉਂਕਿ ਸਾਡੇ ਮਤਲਬ ਖਾਸ ਕੁਛ ਨਹੀਂ ਮਤਲਬ ਸਵਾਈ ਜਿਹੜੇ ਸੂਟ ਸਿਊਂਦੇ ਆ ਉਹ ਕੁਛ ਇੱਦਾਂ ਦੇ ਹੁੰਦੇ ਆ ਕਿ ਮਤਲਬ ਸਾਡੇ ਨਹੀਂ ਵੀ ਦਿਮਾਗ ਵਿੱਚ ਬੈਠ ਬੈਠਦੇ ਮਤਲਬ ਸਾਡਾ ਇੰਟਰਸਟ ਨਹੀਂ ਹੁੰਦਾ ਤਾਂ ਕਰਕੇ ਅਸੀਂ ਮਾੜੀ ਮੋਟੀ ਆਪਣਾ ਖੁਦ ਕਰ ਸਕਦੇ ਹਾਂ ਘਰ ਬੈਠ ਕੇ